ਬੁਣਾਈ ਲਈ ਸਲਾਈਆਂ ਅਤੇ ਕਰੋਸ਼ੀਆ ਪਸ਼ਮ ਦੀ ਜ਼ਰੂਰਤ ਹੁੰਦੀ ਹੈ ਸਿਲਾਈ ਲਈ ਮਸ਼ੀਨ ਦੀ ਜ਼ਰੂਰਤ ਹੁੰਦੀ ਹੈ ਇਸ ਇਸ ਧਾਗੇ ਦੀ ਵੀ ਲੋੜ ਹੁੰਦੀ ਹੈ ਸਿਲਾਈ ਅਤੇ ਬੁਣਾਈ ਲਈ ਧਾਗਾ ਅਲੱਗ ਅਲੱਗ ਤਰ੍ਹਾਂ ਦਾ ਹੁੰਦਾ ਹੈ ਮੇਰੇ ਕੋਲ ਸਿਲਾਈ ਮਸ਼ੀਨ ਹੈ ਅਤੇ ਮੈਂ ਹੱਥ ਤੋਂ ਚਲਾਉਂਦੀ ਹਾਂ ਜਿਸ ਦੇ ਮੈਂ ਕੱਪੜੇ ਸਿਉਂਦੀ ਹਾਂ ਅਤੇ ਪਰ ਮੋਟਰ ਵਾਲੀ ਮਸ਼ੀਨ ਪੈਰ ਨੂੰ ਖਰੀਦਣ ਪਸੰਦ ਕਰਦੀ ਹੈ ਤਾਂ ਕਿਉਂਕਿ ਇਸ ਇਸ 'ਤੇ ਜਲਦੀ ਹੀ ਕੱਪੜੇ ਸੀਤੇ ਜਾਂਦੇ ਹਨ ਸਮਾਂ ਵੀ ਘੱਟ ਲੱਗਦਾ ਹੈ ਅਤੇ ਅਤੇ ਦਿਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਕੱਪੜੇ ਸੀ ਸੀਤੇ ਜਾਂਦੇ ਹਨ ਸਿਲਾਈ ਲਈ ਜੋ ਧਾਗਾ ਵਰਤਿਆ ਜਾਂਦਾ ਹੈ ਉਹ ਬਾਰੀਕ ਹੁੰਦਾ ਹੈ ਅਤੇ ਬੁਣਾਈ ਲਈ ਜੋ ਪਸ਼ਮ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਮੋਟੀ ਪਸ਼ਮ ਹੁੰਦੀ ਹੈ ਅਤੇ ਬੁਣਾਈ ਵਿੱਚ ਅਸੀਂ ਬੀਡਿੰਗ ਕਰਦੀ ਹਾਂ ਅਤੇ ਵਿੱਚ ਹੀ ਸ ਸਵੈਟਰਾਂ ਨਾਲ ਕੋਟੀਆਂ ਬੁਣਦੇ ਹਾਂ ਸਿਲਾਈ ਵਿੱਚ ਅਸੀਂ ਕੱਪੜੇ ਸਿਉਂਦੇ ਹਾਂ ਅਤੇ ਪਿੰਡਾਂ ਦੀਆਂ ਔਰਤਾਂ ਲਈ ਸਿਲਾਈ ਦੀ ਬੁਣਾਈ ਇਸ ਵਿੱਚ ਸਾਰਾ ਦਿਨ ਲੱਗਦੇ ਹਨ ਅਤੇ ਸਭ ਤੋਂ ਵੱਧ ਪੈਸੇ ਕਮਾਉਂਦੀਆਂ ਹਨ ਇਸ ਚੀਜ਼ ਨਾਲ ਉਹ ਘਰ ਦਾ ਖਰਚਾ ਆਪਣਾ ਕੱਢ ਸਕਦੀਆਂ ਕਰ ਲੈਂਦੇ ਕੱਢ ਲੈਂਦੀਆਂ ਹਨ ਅਤੇ ਅਤੇ ਸਹੀ ਬੁਣਾਈ ਲਈ ਮੇਰੇ ਕੋਲ ਮਸ਼ੀਨ ਹਨ ਪਰ ਮੈਂ ਸੋਚਦੀ ਹਾਂ ਕਿ ਮੇਰੇ ਕੋਲ ਉਸਦੇ ਵਧੀਆ ਮਸ਼ੀਨ ਹੋਵੇ ਅਤੇ ਜਿਸ ਨਾਲ ਮੈਂ ਜੇ ਮਸ਼ੀਨਾਂ ਦੀ ਜਿਸ ਨਾਲ ਮੈਂ ਜ਼ਿਆਦਾ ਕੰਮ ਕਰ ਸਕਾਂ ਅਤੇ ਸਿਲਾਈ ਦੇ ਮਸ਼ੀਨ ਨਾਲ ਕ ਵੱਧ ਕੱਪੜੇ ਬੁਣਾਈ ਅਤੇ ਵੱਧ ਤੋਂ ਵੱਧ ਸ ਸਵੈਟਰ ਕੋਟੀਆਂ ਬਣਾ ਸਕਾਂ ਅਤੇ ਵੱਧ ਕਮਾ ਸਕਾਂ ਪੈ ਪੈਸੇ ਵੱਧ ਕਮਾ ਸਕਾਂ